ਮੇਰੇ ਵਿਭਾਗ ਨੇ ਕੁਝ ਵਿਸ਼ੇਸ਼ ਹੁਕਮਾਂ ਜਾਰੀ ਕੀਤੀਆਂ ਨੇ ਜੋ ਰੈਸਟੋਰੈਂਟਾਂ ਨੂੰ ਦਿੱਤੀਆਂ ਗਈਆਂ ਹਨ ਪਰ ਮੈਂ ਉਹਨਾਂ 'ਤੇ ਪੂਰਾ ਭਰੋਸਾ ਨਹੀਂ ਕਰਦੀ ਕਿ ਉਹ ਇਹ ਹੁਕਮ ਠੀਕ ਤਰ੍ਹਾਂ ਅਨੁਸਾਰ ਪੂਰਾ ਕਰਨਗੇ ਜਾਂ ਨਹੀਂ ਇਸ ਲਈ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਮੈਂ ਇਹ ਤਸਵੀਰ ਪਾ ਸਕਦੀ ਹਾਂ ਕਿ ਕੀ ਮੈਨੂੰ ਜੋ ਹੁਕਮ ਦਿੱਤਾ ਹੈ ਉਸਨੂੰ ਠੀਕ ਤਰ੍ਹਾਂ ਅਨੁਸਾਰ ਨਿਭਾਇਆ ਗਿਆ ਜਾਂ ਨਹੀਂ ਇਹ ਸੰਦੇਸ਼ ਮੇਰੇ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਉਣ ਦਾ ਹੈ ਕਿ ਮੈਂ ਉਹਨਾਂ ਦੇ ਕੰਮ ਨੂੰ ਪਰਖ ਸਕਾਂ ਅਤੇ ਸਾਬਤੀ ਪ੍ਰਦਾਨ ਕਰ ਸਕਾਂ ਮੇਰੇ ਵਿਭਾਗ ਦੀ ਇਹ ਮਿਸ਼ਨ ਹੈ ਕਿ ਸਾਰੇ ਹੁਕਮ ਸਿੱਧੇ ਤਰ੍ਹਾਂ ਅਨੁਸਾਰ ਨਿਭਾਉਣੇ ਚਾਹੀਦੇ ਹਨ ਅਤੇ ਮੈਂ ਆਪਣੀ ਟੀਮ ਨੂੰ ਇਸ ਤਸਵੀਰ ਵਿੱਚ ਅਵਸਰ ਦੇਣਾ ਚਾਹੁੰਦੀ ਹਾਂ ਇਸ ਤਰ੍ਹਾਂ ਸਾਰੀਆਂ ਮਿਹਨਤਾਂ ਨੂੰ ਵਧਾਉਣ ਦਾ ਹੈ ਜੋ ਕਿ ਉਹਨਾਂ ਦੀਆਂ ਮਹੀਨੇ ਬਾਅਦ ਦੀ ਰਿਪੋਰਟ ਨੂੰ ਵੀ ਸਾਹਮਣੇ ਪਾਇਆ ਜਾ ਸਕੇ ਇਹ ਸਭ ਵਾਹਿਗੁਰੂ ਦੀ ਕਿਰਪਾ ਅਤੇ ਟੀਮ ਦੀ ਮਿਹਨਤ ਜ਼ਰੀਏ ਹੀ ਅਸੀਂ ਚੰਗੇ ਨਤੀਜੇ ਪਾ ਸਕਦੇ ਹਾਂ ਧੰਨਵਾਦ